ਭਾਰਤ ਵਿੱਚ ਸਭ ਤੋਂ ਪਸੰਦੀਦਾ ਰਾਜ ਸਾ ਸਾਨੂੰ ਪੰਜਾਬ ਸਾਡਾ ਪੰਜਾਬ ਚੰਗਾ ਲੱਗਦਾ ਹੈ ਜਿੱਥੇ ਅਸੀਂ ਸ਼ੁਰੂ ਤੋਂ ਰਹਿ ਰਹੇ ਹਾਂ ਸਾਡੇ ਬਜ਼ੁਰਗ ਸਾਡੇ ਪੁਰਖ ਰਹਿ ਰਹੇ ਆ ਪੰਜਾਬ ਦੇ ਵਿੱਚ ਕਹਿ ਲਉ ਜਿੱਦਾਂ ਪੰਜਾਬ ਦਾ ਪਾਣੀ ਹੈ ਉਹ ਸਾਡੇ ਵਾਸਤੇ ਅੰਮ੍ਰਿਤ ਹੈ ਸਾਡੇ ਗੁਰੂਆਂ ਨੇ ਸਾਨੂੰ ਐਸੀ ਬਖਸ਼ਿਸ਼ ਕਰੀ ਹੈ ਕਿ ਘੁੰਮਣ ਵਾਸਤੇ ਚਲੇ ਜਾਉ ਗੁਰਦੁਆਰਾ ਸਾਹਿਬ ਚਲੇ ਜਾਉ ਮੱਥਾ ਟੇਕਣ ਦਰਬਾਰ ਸਾਹਿਬ ਅੰਮ੍ਰਿਤਸਰ ਚਲੇ ਜਾਉ ਅਨੰਦਪੁਰ ਸਾਹਿਬ ਚਲੇ ਜਾਉ ਹੈ ਨਾ ਫਤਿਹਗੜ੍ਹ ਸਾਹਿਬ ਚਲੇ ਜਾਉ ਇਹ ਸਭ ਚੀਜ਼ਾਂ ਘੁੰਮਣ ਕਰਕੇ ਸਾਨੂੰ ਸਾਡਾ ਇਤਿਹਾਸ ਜਾਨ ਤੋਂ ਪਿਆਰਾ ਹੈ ਠੀਕ ਹੈ ਜੀ ਸਾਨੂੰ ਸਾਡੇ ਗੁਰੂਆਂ ਨੇ ਜੋ ਸਿਖਾਇਆ ਅਸੀਂ ਉਹਨਾਂ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਬਾਹਰ ਤੋਂ ਕੁਝ ਲੋਕ ਘੁੰਮਣ ਆਉਂਦੇ ਆ ਤਾਂ ਉਹਨਾਂ ਨੂੰ ਅਸੀਂ ਇਹ ਦੱਸਦੇ ਹਾਂ ਪੰਜਾਬ 'ਚ ਜੇ ਅਸੀਂ ਤੁਹਾਡੇ ਵਾਸਤੇ ਕੁਛ ਕਰ ਸਕੇ ਹਾਂ ਤੁਹਾਨੂੰ ਤੁਹਾਡੇ ਵਾਸਤੇ ਕੁਛ ਵੀ ਕਰ ਸਕੇ ਹਾਂ ਤੁਹਾਨੂੰ ਖਾਣ ਨੂੰ ਤੁਹਾਨੂੰ ਰਹਿਣ ਨੂੰ ਤੁਹਾਨੂੰ ਜਗ੍ਹਾ ਦਿੱਤੀ ਹੈ ਜਾਂ ਕੁਛ ਵੀ ਤੁਹਾਡੇ ਲਈ ਕਰਿਆ ਤਾਂ ਸਾਡੇ ਪੰਜਾਬ ਦੀ ਬਾਹਰ ਜਾ ਕੇ ਪ੍ਰਸਿੱਧੀ ਕਰਿਉ ਲੋਕਾਂ ਨੂੰ ਦੱਸਿਉ ਕਿ ਪੰਜਾਬ ਦੇ ਲੋਕ ਕਿੱਦਾਂ ਦੇ ਹੈ ਦਿਲਾਂ ਦੇ ਚੰਗੇ ਹੈ ਜਾਂ ਮਾੜੇ ਹੈ